ਹੈਲੋ ਗੁਡ ਆਫਟਰਨੂਨ ਜੀ ਹਾਂਜੀ ਸਤਿ ਸ਼੍ਰੀ ਕਾਲ ਹਾਂਜੀ ਹਾਂਜੀ ਬੋਲੋ ਕਿਹੜੇ ਟਾਈਮ ਜੀ ਸ਼ਾਮ ਸਵੇਰੇ ਸ਼ਾਮ ਨੂੰ ਹਾਂਜੀ ਅੱਛਾ ਜੀ ਹਾਂਜੀ ਅਤੇ ਸਾਰਾ ਸਮਾਨ ਤੁਹਾਨੂੰ ਐਕਸਪਾਇਅਰ ਚਲ ਗਿਆ ਜੀ ਅੱਛਾ ਜੀ ਠੀਕ ਹੈ ਜੀ ਏ ਤੁਸੀਂ ਕਿਆ ਕਹਿੰਦੇ ਹੈ ਮੈਂ ਸ਼ੌਪ 'ਤੇ ਸੀ ਕਿਹੜਾ ਕਿਹੜਾ ਸਮਾਨ ਹੈ ਉਹਨਾਂ ਦਾ ਲਿਖਾ ਸਕਦੇ ਤੁਸੀਂ ਮੈਨੂੰ ਹਾਂਜੀ ਦੱਸਿਓ ਹਾਂਜੀ ਠੀਕ ਹੈ ਮੈਗੀ ਦੇ ਪੈਕਟ ਕਿੱਦਾ ਵੀ ਛੋਟੇ ਲੈਕੇ ਗਏ ਸੀਗੇ ਬੜੇ ਲੈਕੇ ਗਏ ਸੀਗੇ ਤੁਸੀਂ ਬੜੇ ਪੈਕਟ ਲੈ ਗਏ ਸੀ ਯੀਪੀ ਦੇ ਹਾਂਜੀ ਮੈਂ ਕਿਹਾ ਤੁਸੀਂ ਖੋਲ੍ਹ ਕੇ ਦੇਖਿਆ ਸੀਗਾ ਜੀ ਪੈਕਟ ਅਤੇ ਕਿੰਨੇ ਪੈਕਟ ਲੈ ਕੇ ਗਏ ਸੀ ਕਿੰਨੇ ਪੈਕਟ ਖੋਲੇ ਜੀ ਤੁਸੀਂ ਕਿੰਨੇ ਪੈਕਟ ਖੋਲ ਕੇ ਚੈੱਕ ਕਰੇ ਹੈ ਜਿਹੜਾਂ ਤਾਂ ਤੁਸੀਂ ਪੈਕਟ ਖੋਲਿਆ ਤਾਂ ਜੀ ਉਹ ਨਹੀਂ ਹੋਣਾ ਰਿਟਰਨ ਅਤੇ ਬਾਕੀ ਜਿਹੜਾ ਸਮਾਨ ਏ ਕੋਈ ਨਹੀਂ ਤੁਸੀਂ ਦੇਖ ਲਿਓ ਫਿਰ ਲੈ ਆਇਓ ਆਪਾਂ ਫਿਰ ਚੇਂਜ ਕਰਦਾਂਗਾ ਤੁਸੀਂ ਮੈਂ ਕਿਹਾ ਆ ਜਿਓ ਸ਼ਾਮ ਨੂੰ ਆ ਜਿਓ ਪੰਜ ਕੁ ਵਜੇ ਤੱਕ ਅੱਛਾ ਹਾਲੇ ਮੈਂ ਥੋੜ੍ਹਾ ਬਾਹਰ ਹੈ ਬੇਟਾ ਹੈ ਮੇਰਾ ਓਕੇ ਜੀ